ਅੱਜ ਕੱਲ੍ਹ ਤਾਂ ਸੂਟਾਂ ਦੇ ਨਾਲ ਨਾਲ ਸਲਵਾਰਾਂ ਦਾ ਵੀ ਬਹੁਤ ਵੱਡਾ ਫੈਸ਼ਨ ਹੈ ਜਿਵੇਂ ਕਿ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਛੋਟੇ ਪੌਂਚੇ ਚਲਦੇ ਸੀ ਅਤੇ ਉਹ ਸਿੰਪਲ ਸਲਵਾਰ ਬ ਚੋਰੀ ਬਣਦੀ ਸੀ ਅਤੇ ਹੁਣ ਅੱਜ ਕੱਲ੍ਹ ਬੈਲਟ ਵਾਲੀ ਸਲਵਾਰ ਦਾ ਤਾਂ ਫੈਸ਼ਨ ਬਹੁਤ ਹੈ ਕੋਈ ਤਾਂ ਚੌੜੇ ਪੌਂਚੇ ਬਣਾਉਂਦਾ ਹੈ ਕੋਈ ਸਿੰਪਲ ਜਿਹੇ ਕੋਈ ਬਹੁਤ ਘੱਟ ਅਤੇ ਬਹੁਤ ਜ਼ਿਆਦਾ ਚੌੜਾ ਪੌਂਚਾ ਹੁੰਦਾ ਹੈ ਕੋਈ ਪਟਿਆਲਾ ਕੋਈ ਅਫ਼ਗਾਨੀ ਸਲਵਾਰ ਅਫ਼ਗਾਨੀ ਸਲਵਾਰ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਉਹਨੇ ਨਾਲ ਤਾਂ ਮੈਂ ਪੂਰੀ ਜੱਟੀ ਮੁਟਿਆਰ ਲੱਗਦੀ ਹਾਂ ਪਟਿਆਲਾ ਸਲਵਾਰ ਧੋਤੀ ਸਲਵਾਰ ਅਫ਼ਗਾਨੀ ਸਲਵਾਰ ਅਤੇ ਧੋਤੀ ਸਲਵਾਰ ਸਮੋਸਾ ਸਲਵਾਰ ਤਾਂ ਬਹੁਤ ਹੀ ਜ਼ਿਆਦਾ ਸੂਟਾਂ ਦਾ ਚੁੱਕ ਚਾਂਦ ਲਗਾ ਦਿੰਦੀ ਹੈ ਰੋਹਬ ਕਮੀਜਾਂ ਨਾਲ ਨਾਲੋ ਸੋਹਣੀ ਸਲਵਾਜ ਸੀਤੀ ਹੋਵੇ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਮੈਨੂੰ ਧੋਤੀ ਸਲਵਾਰ ਤਾਂ ਇੰਨੀ ਸੋਹਣੀ ਲੱਗਦੀ ਹੈ ਕਿ ਉਹਦੇ ਨਾਲ ਤਾਂ ਮੇਰਾ ਰੋਹਬ ਵੀ ਨਿੱਖਰ ਆਉਂਦਾ ਹੈ ਸਹੀ ਬੈਲਟ ਵਾਲੀ ਸਲਵਾਰ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ